ਜੇਕਰ ਅਸੀਂ ਵਿਗਿਆਨ ਦੀ ਗੱਲ ਕਰੀਏ ਤਾਂ ਅੱਜ ਦੇ ਸਮੇਂ ਵਿੱਚ ਬਾਰਵੀਂ ਤੋਂ ਬਾਅਦ ਫਿਰ ਨੀਟ ਅਤੇ ਜੇ ਈ ਦੇ ਪੇਪਰ ਹੁੰਦੇ ਹਨ ਜਿਸ ਦੀਆਂ ਬੱਚਿਆਂ ਨੂੰ ਕਲਾਸਾਂ ਲਗਾਉਣੀਆਂ ਪੈਂਦੀਆਂ ਹਨ ਪਰ ਅਸੀਂ ਕਹੀਏ ਤਾਂ ਭਾਰਤ ਵਿੱਚ ਇਹ ਕੋਰਸ ਔਖੇ ਜਾਂ ਸੌਖੇ ਨਹੀਂ ਹੁੰਦੇ ਇਹ ਤਾਂ ਪੜ੍ਹਨ ਵਾਲੇ 'ਤੇ ਡਿਪੈਂਡ ਕਰਦਾ ਹੈ ਕਿ ਉਹ ਕਿਸ ਤਰ੍ਹਾਂ ਇਸ ਤ ਇਸ ਨੂੰ ਪੜ੍ਹ ਰਿਹਾ ਹੈ ਅਤੇ ਕਿਸ ਤਰ੍ਹਾਂ ਇਸ ਦੇ ਚ ਚ ਅੱਗੇ ਵੱਧ ਰਿਹਾ ਹੈ ਸਾਨੂੰ ਹਮੇਸ਼ ਸਾਨੂੰ ਹਮੇਸ਼ਾ ਹੀ ਪੜ੍ਹਨ ਦੀ ਰਣਨੀਤੀ ਬਣਾਉਣੀ ਚਾਹੀਦੀ ਹੈ ਅਤੇ ਵਧੀਆ ਤਰੀਕੇ ਨਾਲ਼ ਪੜ੍ਹਨਾ ਚਾਹੀਦਾ ਹੈ ਤਾਂ ਕੋਈ ਵੀ ਚੀਜ਼ ਇੰਨੀ ਔਖੀ ਨਹੀਂ ਹੁੰਦੀ ਪਰ ਜੇਕਰ ਅਸੀਂ ਖੁਦ ਹੀ ਨਹੀਂ ਇਹ ਚੀਜ਼ ਕਰਨਾ ਚਾਹੁੰਦੇ ਤਾਂ ਸਾਨੂੰ ਹਰ ਕੁਝ ਹੀ ਔਖਾ ਲੱਗਦਾ ਹੈ ਪਰ ਇਹਨਾਂ ਚੀਜ਼ ਵਿਗਿਆਨ ਅਤੇ ਗਣਿਤ ਜਾਂ ਹੋਰ ਚੀਜ਼ਾਂ ਦੀਆਂ ਕਲਾਸਾਂ ਲਗਾਉਣੀਆਂ ਜ਼ਰੂਰੀ ਵੀ ਹਨ ਕਿਉਂਕਿ ਅਧਿਆਪਕ ਜਿਹੜੇ ਕੀ ਇੰਨੇ ਇੰਨੇ ਸਾਲਾਂ ਤੋਂ ਪੜ੍ਹਾ ਰਹੇ ਹਨ ਉਹਨਾਂ ਨੂੰ ਇਸ ਚੀਜ਼ ਬਾਰੇ ਕਾਫ਼ੀ ਨੌਲੇਜ ਸਾਨੂੰ ਵੀ ਦੱਸਦੇ ਹਨ ਅਤੇ ਆਪਣੇ ਵਿਚਾਰ ਵੀ ਦੱਸਦੇ ਹਨ ਕਿਸ ਤਰ੍ਹਾਂ ਉਹਨਾਂ ਨੇ ਵੀ ਇਹਨਾਂ ਐਗਜ਼ਾਮ ਨੂੰ ਕਲੀਅਰ ਕੀਤਾ ਹੈ ਅਤੇ ਇਹਨਾਂ ਵਿੱਚ ਕਿਵੇਂ ਹੀ ਉਹਨਾਂ ਨੇ ਵਧੀਆ ਅੰਕ ਪ੍ਰਾਪਤ ਕੀਤੇ ਹਨ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ